ਮੇਰੇ ਕੋਲ ਪਹਿਲਾਂ ਜੀਓ ਦਾ ਕੀਪੇਡ ਫੋਨ ਸੀ ਪਰ ਉਦੋਂ ਤੋਂ ਸਮਾਰਟਫੋਨ ਤਕਨਾਲੋਜੀ ਬਹੁਤ ਬਦਲ ਗਈ ਹੈ ਹੁਣ ਉਸ ਤੋਂ ਬਾਅਦ ਸਾਰੇ ਟਚ ਫੋਨ ਆ ਗਏ ਹਨ ਅਤੇ ਉਹ ਪੁਰਾਣੇ ਕੀਪੈਡ ਫੋਨ ਲਗਭਗ ਬੰਦ ਹੋ ਗਏ ਹਨ